ਸਤਿ ਸ਼੍ਰੀ ਅਕਾਲ ਜੀ ਏਕਮ ਦੇ ਪੇਰੈਂਟਸ ਬੋਲਦੇ ਹੋ ਅੱਛਾ ਜੀ ਓਹਦਾ ਨਾ ਰਿਜ਼ਲਟ ਆਇਆ ਸੀਗਾ ਜੀ ਅੱਜ ਹਾਂਜੀ ਅਤੇ ਉਹਦੇ ਨੰਬਰ ਬਹੁਤ ਘੱਟ ਆਏ ਨੇ ਉਹਦੇ ਜੀ ਮੈਥ 'ਚ ਵੀ ਘੱਟ ਆ ਸਾਇੰਸ 'ਚ ਵੀ ਘੱਟ ਆ ਹਾਂਜੀ ਇੰਗਲਿਸ਼ ਵਗੈਰਾ ਬਾਕੀ ਤਾਂ ਠੀਕ ਹੈ ਸਬਜੈਕਟ ਇਹਨਾਂ ਵਿੱਚ ਦੋਨਾਂ ਵਿੱਚੋਂ ਘੱਟ ਨੇ ਇਹ ਟਿੱਕ ਕੇ ਬਹਿੰਦਾ ਨਹੀਂ ਹੈਗਾ ਜੀ ਬਸ ਕਦੇ ਇੱਧਰ ਕਦੇ ਉੱਧਰ ਬਸ ਇਹਨੂੰ ਮਾੜਾ ਮੋਟਾ ਸਮਝਾਓ ਪਿਆਰ ਨਾਲ਼ ਵੀ ਅੱਗੇ ਪੜ੍ਹੇ ਪੜ੍ਹ ਸਕਦਾ ਜੀ ਇਹ ਬਸ ਕੋਸ਼ਿਸ਼ ਨਹੀਂ ਕਰਦਾ ਹੈਗਾ ਕਦੇ ਇੱਧਰ ਕਦੇ ਉੱਧਰ ਬਸ ਜ਼ੋਰ ਰਹਿੰਦਾ ਇਹਦਾ ਗੱਲਾਂ ਕਰਨ 'ਤੇ ਰਹਿੰਦਾ ਕਲਾਸ 'ਚ ਘੁੰਮਣ ਨੂੰ ਖੇਡਣ ਨੂੰ ਹੀ ਰਹਿੰਦਾ ਬਸ ਇਹ ਨਹੀਂ ਟਿਊਸ਼ਨ ਦੀ ਤਾਂ ਹਜੇ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਘਰ ਤਿਆਰੀ ਕਰਾਓ ਇਹਦੀ ਪ੍ਰਪੇਅਰ ਕਰਾਓ ਵਧੀਆ ਆਪ ਪੜ੍ਹੇਗਾ ਹੌਲੀ ਹੌਲੀ ਤੁਸੀਂ ਇਹਨੂੰ ਪਿਆਰ ਨਾਲ਼ ਸਮਝਾਓ ਟਿਊਸ਼ਨ ਦੀ ਫਿਲਹਾਲ ਤਾਂ ਹਲੇ ਕੋਈ ਲੋੜ ਨਹੀਂ ਹੈਗੀ ਇਹਨੂੰ

ਹਾਂ ਉਹ ਸਾਰੇ ਠੀਕ ਆ ਜੀ ਬਸ ਬਾਕੀ ਇਹਦੇ ਮੈਥ ਉੱਪਰ ਜ਼ਿਆਦਾ ਜ਼ੋਰ ਦਓ ਹਾਂਜੀ ਇਹ ਮੈਥ ਵੱਲ ਥੋੜ੍ਹਾ ਜ਼ਿਆਦਾ ਵੀਕ ਆ ਉੱਧਰਲੀ ਸਾਈਡ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਇਹਨੂੰ ਹਾਂਜੀ ਇਹਨੂੰ ਥੋੜ੍ਹਾ ਘਰ ਸਮਝਾਇਆ ਕਰੋ ਵੀ ਕਿਵੇਂ ਉਹ ਕਰਨਾ ਹੁੰਦਾ ਅਤੇ ਮੈਥ 'ਚ ਜ਼ਿਆਦਾ ਉਹ ਦਿਆ ਕਰੋ ਇਹਨੂੰ ਕਲਾਸਿਸ ਦਿਆ ਕਰੋ ਘਰ ਉਹ ਤੁਹਾਨੂੰ ਦੱਸ ਦਾਂਗੇ ਡੇਟਸ਼ੀਟ ਆਵੇਗੀ ਹਾਂਜੀ ਉਹਦੇ ਵਿੱਚ ਦੱਸ ਦਾਂਗੇ ਜਦੋਂ ਅਗਲੇ ਹੁਣ ਮੈਨੂੰ ਲੱਗਦਾ ਆਈ ਥਿੰਕ ਮਾਰਚ 'ਚ ਹੋਣਗੇ ਤਾਂ ਤੁਹਾਨੂੰ ਡੇਟਸ਼ੀਟ ਦੱਸ ਦਾਂਗੇ ਪਹਿਲਾਂ ਹਾਂਜੀ ਹਾਂਜੀ ਅਤੇ ਇਹਨੂੰ ਥੋੜ੍ਹਾ ਜਿਹਾ ਘਰ ਸਮਝਾਓ ਜੀ ਨਹੀਂ ਨਹੀਂ ਇਹਨੂੰ ਕਾਰਡ ਮਿਲੇਗਾ ਤੁਹਾਨੂੰ ਦੱਸਦੂੰਗੇ ਕਿ ਉਹ ਵੱਟਸੈਪ ਦੇ ਗਰੁੱਪ 'ਤੇ ਹੈਗੇ ਹੋ ਉੱਦਾਂ ਦੱਸ ਦਾਂਗੇ ਤੁਹਾਨੂੰ ਜਿਵੇਂ ਹੋਇਆ ਹਾਂਜੀ ਹਾਂਜੀ ਅਤੇ ਬਾਕੀ ਇਹਦੇ 'ਤੇ ਧਿਆਨ ਦਓ ਥੋੜ੍ਹਾ ਜਿਹਾ ਹਾਂਜੀ ਧਿਆਨ ਦਓ ਉੱਦਾਂ ਤਾਂ ਪੜ੍ਹਨ ਵਾਲਾ ਹੈਗਾ ਜਵਾਕ ਥੋੜ੍ਹਾ ਜਿਹਾ ਧਿਆਨ ਦਓ ਬਿਚਾਰੇ 'ਤੇ ਹਾਂਜੀ ਹਾਂਜੀ ਕੋਈ ਨਹੀਂ ਜ਼ਰੂਰ ਜੀ ਜ਼ਰੂਰ ਹਾਂਜੀ ਠੀਕ ਹੈ ਜੀ